ਸਤਿ ਸ਼੍ਰੀ ਅਕਾਲ ਜੀ ਐੱਲ ਪੀ ਜੀ ਗੈਸ ਦੇ ਲਈ ਸਾਨੂੰ ਥੋੜ੍ਹਾ ਧਿਆਨ ਰੱਖਣਾ ਪੈਂਦਾ ਸਾਨੂੰ ਥੋੜ੍ਹਾ ਅਲਰਟ ਰਹਿਣਾ ਚਾਹੀਦਾ ਸਾਨੂੰ ਪਹਿਲਾਂ ਤਾਂ ਰੈਗੂਲੇਟਰ ਨੂੰ ਚੈੱਕ ਕਰਨਾ ਚਾਹੀਦਾ ਆ ਕਿ ਉਹ ਚ ਚੰਗੇ ਤਰੀਕੇ ਨਾਲ ਬੰਦ ਹੋਇਆ ਆ ਕਿ ਨਹੀਂ ਖਾਣਾ ਬਣਾਉਣ ਤੋਂ ਬਾਅਦ ਅਸੀਂ ਜਦੋਂ ਗੈਸ ਬੰਦ ਕਰ ਦਿੰਦੇ ਹਾਂ ਉਸ ਗੈਸ ਨੂੰ ਬੰਦ ਕਰਨ ਤੋਂ ਬਾਅਦ ਵੀ ਇੱਕ ਵਾਰ ਦੇਖਣਾ ਚਾਹੀਦਾ ਆ ਕਿ ਉਹ ਬੰਦ ਹੋਇਆ ਵਾ ਕਿ ਨਹੀਂ ਹੋਇਆ ਉਸ ਤੋਂ ਬਾਅਦ ਰਾਤ ਨੂੰ ਸੌਣ ਲੱਗਿਆ ਵੀ ਸਾਨੂੰ ਉਸ ਗ ਸਿਲੰਡਰ ਨੂੰ ਐੱਲ ਪੀ ਜੀ ਗੈਸ ਨੂੰ ਬੰਦ ਕਰਕੇ ਸੌਣਾ ਚਾਹੀਦਾ ਆ ਫਿਰ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਆ ਕਿ ਜਿਹੜੀ ਉਹਦੀ ਪਾਈਪ ਹੁੰਦੀ ਆ ਨਾ ਕਈ ਵਾਰ ਕੀ ਹੁੰਦਾ ਕਿ ਉਹ ਪਾਈਪ ਘਰਾਂ 'ਚ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹ ਪਾਈਪ ਕਿੰਨਾ ਕਿੰਨਾ ਚਿਰ ਤੱਕ ਚਲਦੀ ਰਹਿੰਦੀ ਆ ਚਲਦੀ ਰਹਿੰਦੀ ਆ ਪਰ ਸਾਨੂੰ ਇਸ ਚੀਜ਼ ਨਾਲ ਧਿਆਨ ਰੱਖਣਾ ਚਾਹੀਦਾ ਉਹ ਪਾਈਪ ਜਿਹੜੀ ਆ ਕਿ ਉਹਨੂੰ ਟਾਈਮ ਟਾਈਮ 'ਤੇ ਬਦਲਣਾ ਚਾਹੀਦਾ ਆ ਉਸ ਪਾਈਪ ਨੂੰ ਦੇਖਣਾ ਚਾਹੀਦਾ ਉਹ ਕਿਤੇ ਕੱਟੀ ਜਾਂ ਫਟੀ ਤਾਂ ਨਹੀਂ ਹੈਗੀ ਕਿਤੇ ਕਿਸੇ ਪਾਸਿਉਂ ਲੀਕ ਤਾਂ ਨਹੀਂ ਕਰਦੀ ਪਈ ਆਮ ਤੌਰ 'ਤੇ ਕਾਫੀ ਐਕਸੀਡੈਂਟਸ ਇੱਦਾਂ ਹੀ ਪਿੱਛੇ ਜਿਹੇ ਸੁਣਨ ਨੂੰ ਮਿਲੇ ਆ ਕਿ ਗੈਸ ਸਿਲੰਡਰ ਫਟਣ ਦੇ ਕਾਰਨ ਬਹੁਤ ਘਰਾਂ 'ਚ ਮੌਤਾਂ ਹੋਈਆਂ ਉਹ ਮੌਤਾਂ ਇਸ ਕਾਰਨ ਹੋਈਆਂ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਅਸੀਂ ਆਪਣੇ ਘਰ ਦੀ ਪਾਈਪ ਬਦਲਣੀ ਵੀ ਆ ਅਤੇ ਛੇ ਮਹੀਨੇ ਬਾਅਦ ਹੋ ਸਕੇ ਤਾਂ ਆਪਣੀ ਪਾਈਪ ਨੂੰ ਬਦਲ ਲਉ ਚੈੱਕ ਕਰਦੇ ਰਹੋ ਉਸ ਪਾਈਪ ਨੂੰ ਜ਼ਰੂਰੀ ਨਹੀਂ ਕਿ ਅਸੀਂ ਉਸ ਸਿਲੰਡਰ ਨੂੰ ਬੰਦ ਕਰਨ ਦੀ ਬਸ ਸਾਡੀ ਇੰਨੀ ਕੁ ਜ਼ਿੰਮੇਦਾਰੀ ਕਿ ਅਸੀਂ ਉਹਨੂੰ ਬੰਦ ਕਰਨਾ ਆ ਉਹਨੂੰ ਬੰਦ ਕਰਨਾ ਸਾਡੀ ਜ਼ਿੰਮੇਦਾਰੀ ਨਹੀਂ ਆ ਉਹਨੂੰ ਦੇਖਣਾ ਵੀ ਆ ਕਿ ਉਸ 'ਚ ਕੋਈ ਦਿੱਕਤ ਤਾਂ ਨਹੀਂ ਆਈ ਅਤੇ ਬੱਚਿਆਂ ਨੂੰ ਸਿਲੰਡਰ ਤੋਂ ਦੂਰ ਰੱਖਣਾ ਚਾਹੀਦਾ ਬੱਚੇ ਸ਼ਰਾਰਤੀ ਹੁੰਦੇ ਬੱਚੇ ਜੋ ਦੇਖਦੇ ਆ ਉਹਨੂੰ ਪੂਰਾ ਕੌਪੀ ਪੇਸਟ ਕਰਕੇ ਆਉਂਦੇ ਆ ਅਤੇ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਿਆਂ ਦੇ ਸਾਹਮਣੇ ਅਸੀਂ ਇੱਦਾਂ ਉਪਯੋਗ ਨਾ ਕਰੀਏ ਅਤੇ ਬੱਚਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਗੈਸ ਸਿਲੰਡਰ ਤੋਂ ਦੂਰ ਰੱਖਿਆ ਜਾਵੇ ਤਾਂ ਜੋ ਉਹ ਉਹਨੂੰ ਚਲਾ ਚਲਾ ਕੇ ਦੇਖਣ ਨਾ ਸਾਡੇ ਲਾਗੇ ਗੁਆਂਢੀਆਂ ਦੀ ਕੁੜੀ ਆ ਉਹ ਇਸ ਤਰ੍ਹਾਂ ਕਰਦੀ ਆ ਤਾਂ ਕਰਕੇ ਮੈਂ ਦੱਸਦੀ ਪਈ ਹਾਂ ਕਿੰਨੀ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਬੱਚਿਆਂ ਨੂੰ ਸਿਲੰਡਰ ਤੋਂ ਚੁੱਲ੍ਹੇ ਤੋਂ ਦੂਰ ਰੱਖਣਾ ਚਾਹੀਦਾ ਵਾ ਅਤੇ ਸਾਨੂੰ ਖਾਣਾ ਬਣਾਉਣ ਤੋਂ ਬਾਅਦ ਉਹਨੂੰ ਚੈੱਕ ਜ਼ਰੂਰ ਕਰਨਾ ਚਾਹੀਦਾ ਕਿ ਉਹ ਬੰਦ ਹੋਇਆ ਵਾ ਕਿ ਨਹੀਂ ਹੋਇਆ